ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਤੁਹਾਡੀ ਸਟੂਡੈਂਟ ਹੀ ਬੋਲ ਰਹੀ ਹਾਂ ਸਰ ਸਾਡਾ ਸਾਡਾ ਨਾ ਪਰਸੋਂ ਜੋਗ੍ਰਾਫੀ ਦਾ ਪੇਪਰ ਸੀਗਾ ਅਤੇ ਮੈਨੂੰ ਸਰ ਡਾਊਟ ਸੀਗਾ ਜਿਹੜਾ ਸਾਡਾ ਪੰਜਾਬ ਦੇ ਬਾਰਡਰ ਲੱਗਦੇ ਨੇ ਸਰ ਉਹ ਚਾਰ ਸੀਗੇ ਜਾ ਤਿੰਨ ਸੀਗੇ ਮਤਲਬ ਮੈਨੂੰ ਮਿਲ ਨਹੀਂ ਰਿਹਾ ਹੈਗਾ ਨਾ ਮੈਨੂੰ ਨੋਟਬੁੱਕ ਦੇ ਵਿੱਚ ਮਿਲਿਆ ਨਾ ਮੈਨੂੰ ਗੂਗਲ 'ਤੇ ਸਹੀ ਪਤਾ ਲੱਗ ਰਿਹਾ ਸਰ ਅੱਛਾ ਸਰ ਅੱਛਾ ਸਰ ਅੱਛਾ ਸਰ ਠੀਕ ਹੈ ਸਰ ਵੈਸੇ ਕੁਸ਼ਚਨ ਜੇ ਆਏਗਾ ਤਾਂ ਦੋ ਨੰਬਰ ਦੇ ਵਿੱਚ ਆਏਗਾ ਠੀਕ ਹੈ ਸਰ ਜੇ ਚਾਰ ਨੰਬਰ ਦੇ ਵਿੱਚ ਆਉਂਦਾ ਤਾਂ ਮਤਲਬ ਥੋੜ੍ਹੀ ਥੋੜ੍ਹੀ ਡਿਟੇਲ ਹੋਰ ਐਡ ਕਰ ਸਕਦੇ ਹਾਂ ਹੋਰ ਸਰ ਨਦੀਆਂ ਦੇ ਬਾਰੇ ਵੀ ਦੱਸ ਸਕਦੇ ਹਾਂ ਸਰ ਅੱਛਾ ਸਰ ਅੱਛਾ ਸਰ ਓਕੇ ਸਰ ਹਾਂਜੀ ਸਰ ਇਲੈਬੋਰੇਟ ਕਰ ਦਵਾਂਗੇ ਸਰ ਅੱਛਾ ਸਰ ਠੀਕ ਹੈ ਸਰ ਠੀਕ ਹੈ ਸਰ ਹਰਿਆਣਾ ਹਾਂਜੀ

ਠੀਕ ਹੈ ਸਰ ਸਰ ਉਹ ਹੀ ਕਿ ਮਤਲਬ ਤਿੰਨ ਬੋਰਡਰ ਹੈਗੇ ਤੁਸੀਂ ਸਾਈਡਜ਼ ਵੀ ਦੱਸ ਦਿੱਤੀਆਂ ਕਿੱਦਾਂ ਕਿੱਦਾਂ ਕਰਕੇ ਮਤਲਬ ਕਿੱਧਰੋਂ ਆਪਣੇ ਬੋਰਡਰ ਮਿਲਦਾ ਜਾ ਕੇ ਅਤੇ ਫਿਰ ਮੈਂ ਕੋਸ਼ਿਸ਼ ਕਰੂੰਗੀ ਪੂਰੇ ਡਿਟੇਲ ਦੇ ਵਿੱਚ ਕੰਫੋਰਮ ਹੀ ਕਰਨਾ ਸਰ ਕਿਉਂਕਿ ਕਾਫੀ ਜਗ੍ਹਾ 'ਤੇ ਤਿੰਨ ਹੈਗਾ ਅਤੇ ਕਾਫੀ ਜਗ੍ਹਾ 'ਤੇ ਚਾਰ ਤਾਂ ਤੁਸੀਂ ਹੁਣ ਦੱਸ ਦਿੱਤਾ ਕਿ ਤਿੰਨ ਹੈਗੇ ਠੀਕ ਹੈ ਸਰ ਹਾਂਜੀ ਸਰ ਸਰ ਆ ਗਿਆ ਸਰ ਹੁਣ ਇੰਨਾ ਯਾਦ ਨਹੀਂ ਰਹਿੰਦਾ ਹੈਗਾ ਬਾਕੀ ਨੋਟ ਲਿਖ ਕੇ ਯਾਦ ਕਰਕੇ ਫਿਰ ਪੇਪਰ 'ਚ ਲਿਖ ਕੇ ਆਉਂਗੀ ਸਰ ਸਰ ਇਕ ਤੁਸੀਂ ਦੱਸਿਆ ਕਿ ਹਰਿਆਣਾ ਵਾਲਾ ਹੁੰਦਾ ਅਤੇ ਸਰ ਇੱਕ ਰਾਜਸਥਾਨ

ਰਾਜਸਥਾਨ ਸਰ ਸਾਊਥ ਸਾਊਥ ਹਰਿਆਨਾ ਔਰ ਰਾਜਸਥਾਨ ਸਾਊਥ ਵੱਲ ਹੁੰਦੇ ਆ ਅਤੇ ਹਿਮਾਚਲ ਪ੍ਰਦੇਸ਼ ਨੋਰਥ ਈਸਟ ਹਾਂਜੀ ਸਰ ਅਤੇ ਜੰਮੂ ਐਂਡ ਕਸ਼ਮੀਰ ਨੋਰਥ ਵੱਲ

ਠੀਕ ਹੈ ਸਰ ਥੈਂਕ ਯੂ ਸਰ